ਵਧੀਆ ਬਾਈ ਜੀ ਤੁਸੀਂ ਦੱਸੋ ਠੀਕ ਹੋ ਹਾਂਜੀ ਸਭ ਵਧੀਆ ਜੀ ਤੁਸੀਂ ਦੱਸੋ ਤੁਹਾਨੂੰ ਪਤਾ ਹੀ ਆ ਭਾਅ ਕਿੰਨਾ ਕੁ ਲਾਉਂਦੀਆਂ ਸਰਕਾਰਾਂ ਹੋਰ ਕੀ ਆ ਜਿੰਨਾ ਕੁ ਮਿਲੇ ਓ ਧਰਨੇ 'ਤੇ ਗਏ ਸੀਗੇ ਫਿਰ ਵੀ ਨਹੀਂ ਰੇਟ ਚੱਕਦੇ ਪਏ ਗੇ ਝੋਨੇ ਤੋਂ ਬਾਅਦ ਦੇਖੋ ਕੀ ਬੀਜੀਏ ਹੁਣ ਸਬਜ਼ੀਆਂ ਹੀ ਬੀਜਾਂਗੇ ਹੁਣ ਅੱਛਾ ਜੀ ਅੱਛਾ ਜੀ ਕੋਈ ਨਹੀਂ ਕੱਢ ਲਵਾਂਗੇ ਟਾਈਮ ਜਿੱਦਣ ਭਾਈ ਤੁਸੀਂ ਵਿਹਲੇ ਹੋਏ ਹਾਂਜੀ ਆ ਜ਼ਮੀਨਾਂ ਦੀ ਉਪਜਾਊ ਸ਼ਕਤੀ ਘਟੀ ਜਾਂਦੀ ਆ ਅਤੇ ਫਸਲਾਂ ਪੂਰੀਆਂ ਹਾਂਜੀ ਝਾੜ ਓਨਾ ਆਉਂਦਾ ਨਹੀਂ ਪਿਆ ਗਾ ਸਹੀ ਗੱਲ ਹੈ ਜੀ ਹਾਂਜੀ ਸਹੀ ਗੱਲ ਹੈ ਹਾਂਜੀ ਹਾਂਜੀ ਜ਼ਰੂਰ ਦੱਸਿਓ ਨਹੀਂ ਹਾਲੇ ਆਪਾਂ ਖਾਦਾਂ ਦੀ ਵਰਤੋਂ ਤਾਂ ਆਪਾਂ ਤਾਂ ਨਹੀਂ ਕਰਨੀ ਗੀ ਅਤੇ ਖਾਦਾਂ ਜਿਹੜੇ ਪਾਉਂਦੇ ਉਹਨਾਂ ਨੂੰ ਵੀ ਰੋਕਾਂਗੇ ਆਪਾਂ ਅਤੇ ਵੱਧ ਤੋਂ ਵੱਧ ਹਾਂਜੀ ਠੀਕ ਹੈ ਬਾਈ ਜੀ ਓਕੇ ਜੀ